ਹਾਂਜੀ ਅਸੀਂ ਆਪਣਾ ਸਿਲਾਈ ਕਢਾਈ ਅਤੇ ਜਿਵੇਂ ਕਿ ਕਰੋਸ਼ੀਆ ਬੁਣਨਾ ਸਲਾਈਆਂ ਸਿੱਖਣਾ ਇਹ ਆਦਿ ਕੰਮ ਮੈਂ ਆਪਣੇ ਦਾਦੀ ਜੀ ਕੋਲੋਂ ਸਿੱਖਿਆ ਸੀ ਉਹ ਹਮੇਸ਼ਾ ਸਿਲਾਈ ਅਤੇ ਕਰੋਸ਼ੀਆ ਆਦਿ ਨਾਲ ਕੋਈ ਵੀ ਸਮਾਨ ਬਣਾ ਲੈਂਦੇ ਸਨ ਜਿਵੇਂ ਕਿ ਸਵੈਟਰ ਕੋਟੀਆਂ ਬਣਾਉਂਦੇ ਸਨ ਸਕਾਫ ਵਗੈਰਾ ਬਣਾਉਂਦੇ ਸਨ ਅਤੇ ਉਹਨਾਂ ਤੋਂ ਹੌਲੀ ਹੌਲੀ ਮੈਂ ਵੀ ਸਿਲਾਈਆਂ ਅਤੇ ਕਰੋਸ਼ੀਆ ਬੁਣਨਾ ਸਿੱਖਿਆ ਸੀ ਕਿ ਉਹ ਮੈਨੂੰ ਵੀ ਸਿਖਾ ਸਕਣ ਅਤੇ ਯਾਦਗਾਰੀ ਪਲ ਉਹਨਾਂ ਨਾਲ ਮੈਂ ਬਹੁਤ ਜ਼ਿਆਦਾ ਬਿਤਾਏ ਹਨ ਕਦੀ ਸਿਲਾਈਆਂ ਸਿੱਖਣਾ ਕਦੀ ਕਰੋਸ਼ੀਆ ਬੁਣਨਾ ਕਦੀ ਧਾਗਾ ਕਦੀ ਕੁਛ ਅਤੇ ਕਦੀ ਡਿਜ਼ਾਇਨ ਬਣਾਉਣਾ ਸਿਖਾਉਂਦੇ ਸਨ ਅਤੇ ਪਹਿਲਾ ਸਭ ਤੋਂ ਪਹਿਲਾਂ ਕਰੋਸ਼ੀਆ ਫੜਨਾ ਅਤੇ ਉੱਨ ਨਾਲ ਕਿਵੇਂ ਕੰਮ ਸ਼ੁਰੂ ਹੁੰਦਾ ਹੈ ਉਹ ਸਿਖਾਇਆ ਜਾਂਦਾ ਸੀ ਅਤੇ ਕਰੋਸ਼ੀਏ ਨਾਲ ਪਹਿਲਾਂ ਜੰਜੀਰ ਬਣਾਈ ਜਾਂਦੀ ਹੈ ਜੰਜੀਰ ਬਣਾਉਣ ਤੋਂ ਬਾਅਦ ਉਸ ਨੂੰ ਸਾਰਾ ਸਿਖਾਇਆ ਜਾਂਦਾ ਹੈ ਉਸ ਨਾਲ ਕਿਵੇਂ ਕੰਮ ਕਰਨਾ ਹੈ ਅਤੇ ਉਸ ਦੇ ਉੱਪਰ ਕਿਵੇਂ ਡਿਜ਼ਾਇਨ ਪਾਉਣਾ ਹੈ ਇਹ ਸਭ ਕੁਝ ਮੈਂ ਆਪਣੀ ਦਾਦੀ ਜੀ ਕੋਲੋਂ ਸਿੱਖਿਆ ਸੀ ਕਿ ਮੇਰੇ ਉਹਨਾਂ ਨਾਲ ਬਹੁਤ ਯਾਦਗਾਰ ਪਲ ਹਨ